ਮੈਂ ਮੌਜੂਦਾ ਪੌਦਿਆਂ ਤੋਂ ਹੋਰ ਕਈ ਤਰਾਂ ਦੇ ਪੌਦੇ ਪੈਦਾ ਕਰਨ ਲਈ ਜ਼ਿਆਦਾਤਰ ਮੈਂ ਵਧੀਆ ਪੌਦੇ ਜਿਹੜੇ ਹੁੰਦੇ ਨੇ ਉਹ ਮਤਲਬ ਮੈਂ ਚੁਣ ਲੈਂਦਾ ਹਾਂ ਅਤੇ ਵਧੀਆ ਪੌਦਿਆਂ ਨੂੰ ਮਤਲਬ ਮੈਂ ਨਵਾਂ ਬੀਜ ਤਿਆਰ ਕਰਦਾ ਹਾਂ ਉਹਨਾਂ ਤੋਂ ਮਤਲਬ ਉਹਨਾਂ ਨੂੰ ਹਾਈਬ੍ਰਿਡਾਈਜੇਸ਼ਨ ਕਰਵਾ ਕੇ ਜਿਹਨਾਂ ਨੂੰ ਕਹਿੰਦੇ ਵੀ ਕ੍ਰੋਸਿੰਗ ਕਰਵਾ ਕੇ ਆਪਣਾ ਹਾਈਬਰਿਡ ਬੀਜ ਨਵਾਂ ਤਿਆਰ ਕਰਦਾ ਹਾਂ ਉਸ ਤੋਂ ਨਵੇਂ ਪੌਦੇ ਤਿਆਰ ਕਰਦਾ ਹਾਂ ਤਾਂ ਕਿ ਮੈਨੂੰ ਵੱਧ ਮੁਨਾਫਾ ਹੋ ਸਕੇ ਅਤੇ ਵੱਧ ਝਾੜ ਦੇ ਸਕੇ